ਨਵਜੰਮੇ ਬੱਚੇ ਦੇ ਰਸਮ ਨਵਜੰਮੇ ਦੇ ਬੱਚੇ ਦੀਆਂ ਰਸਮਾਂ ਬਹੁਤ ਸਾਰੀਆਂ ਨੇ ਜਿਵੇਂ ਕਿ ਮੈਂ ਸਿੱਖ ਧਰਮ ਨੂੰ ਬਲੋਂਗ ਕਰਦਾ ਤਾਂ ਉਸ ਵਿੱਚ ਸਭ ਤੋਂ ਪਹਿਲਾਂ ਰਸਮ ਆਉਂਦੀ ਹੈ ਗੁੜ੍ਹਤੀ ਦੀ ਜਿਸ ਵਿੱਚ ਅਨੰਦ ਜਪੁ ਜੀ ਸਾਹਿਬ ਦਾ ਪਾਠ ਕਰਕੇ ਅਨੰਦ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਕਰਕੇ ਅਤੇ ਉਸ ਤੋਂ ਅਰਦਾਸ ਕੀਤੀ ਜਾਂਦੀ ਹੈ ਅਤੇ ਬਾਟੇ ਵਿੱਚ ਪਤਾਸਿਆਂ ਨੂੰ ਘੋਲਿਆ ਜਾਂਦਾ ਹੈ ਅਤੇ ਉਸ ਦੀ ਗੁੜ੍ਹਤੀ ਦਈ ਜਾਂਦੀ ਹੈ ਅਤੇ ਗੱਲ ਕਰੀਏ ਨਾਮਕਰਣ ਦੀ ਨਾਮਕਰਣ ਦੀ ਵੀ ਅਲੱਗ ਤੋਂ ਇੱਕ ਰਸਮ ਹੈ ਸਿੱਖ ਧਰਮ ਵਿੱਚ ਜਿਵੇਂ ਕਿ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਜਾ ਕੇ ਜੋ ਵੀ ਹੁਕਮਨਾਮਾ ਸਾਹਿਬ ਆਉਂਦਾ ਹੈ ਉਹ ਹੁਕਮਨਾਮਾ ਸਾਹਿਬ ਸੁਣਦੇ ਨੇ ਪਹਿਲਾਂ ਤਾਂ ਹੁਕਮਨਾਮਾ ਸੁਣ ਕੇ ਅਤੇ ਜੋ ਹੁਕਮਨਾਮਾ ਸਾਹਿਬ ਦਾ ਪਹਿਲਾ ਅੱਖਰ ਹੈ ਉਸ ਤੋਂ ਨਾਮ ਰੱਖਿਆ ਜਾਂਦਾ ਹੈ ਜਿਵੇਂ ਕਿ ਰਾਰਾ ਰਾਰੇ ਤੋਂ ਰਵਨੀਤ ਸਿੰਘ ਅ ਹਰਵਿੰਦਰ ਸਿੰਘ ਇੱਦਾਂ ਦੇ ਆਦਿ ਨਾਮ ਜੋ ਉਨ੍ਹਾਂ ਦੀ ਮਰਜ਼ੀ ਹੈ ਘਰ ਦੇ ਫੈ ਫੈਮਿਲੀ ਦੇ ਮਤਲਬ ਕਿ ਜੋ ਉਨ੍ਹਾਂ ਨੂੰ ਪੰਸਦ ਹੈ ਉਸ ਤਰ੍ਹਾਂ ਦਾ ਨਾਮ ਰੱਖਿਆ ਜਾਂਦਾ ਹੈ ਜਾਂ ਉਹ ਰੱਖਦੇ ਨੇ ਜਾਂ ਫਿਰ ਗੁਰਦੁਆਰਾ ਸਾਹਿਬ ਵਿੱਚ ਜੋ ਪਾਠੀ ਸਿੰਘ ਹੁੰਦੇ ਨੇ ਉਹ ਨਾਮ ਦਾ ਜੋ ਅੱਖਰ ਨਿਕਲਿਆ ਹੁੰਦਾ ਉਸ ਤੋਂ ਆਪਣੇ ਆਪ ਹੀ ਨਾਮ ਉਹ ਸੋਚ ਕੇ ਦੱਸ ਦਿੰਦੇ ਨੇ ਵੀ ਇਹ ਰੱਖ ਲਉ ਇੱਦਾਂ ਹੀ ਜੇ ਘਰ ਜਾ ਕੇ ਮਤਲਬ ਕਿ ਸੈਲੀਬਰੇਟ ਕਰਨਾ ਹੁੰਦਾ ਹੈ ਬੱਚੇ ਦਾ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦੇ ਨੇ ਉਸ ਤੋਂ ਬਾਅਦ ਕੇਕ ਵਗੈਰਾ ਕੱਟ ਕਰਦੇ ਨੇ ਅਤੇ ਹੋਰ ਵੀ ਬਹੁਤ ਕੁਝ ਕਰਦੇ ਨੇ ਲੰਗਰ ਵਗੈਰਾ ਕਰਦੇ ਨੇ ਅਤੇ ਇੱਦਾਂ ਹੀ ਗੱਲ ਕਰੀਏ ਲੋਹੜੀ ਦੀ ਲੋਹੜੀ ਨੂੰ ਜਿੱਦਾਂ ਕਿ ਬੱਚਾ ਹੋਇਆ ਹੁੰਦਾ ਹੈ ਨਾ ਮੇਨ ਜ਼ਿਆਦਾਤਰ ਸਿੱਖ ਧਰਮ ਵਿੱਚ ਨਾ ਲੋਹੜੀ ਵੰਡੀ ਜਾਂਦੀ ਹੈ ਸੋ ਇ ਇਹ ਹੀ ਹੁੰਦੇ ਹੈ ਸਿੱਖ ਨਵਜੰਮੇ ਬੱਚਿਆਂ ਲਈ ਸਿੱਖ ਧਰਮ ਵਿੱਚ ਰਿਵਾਜ਼